ਮੋਹਾਲੀ ਜ਼ਿਲ੍ਹੇ ਵਿੱਚ ਅੱਜ ਕੱਲ੍ਹ ਪ੍ਰੋਪਰਟੀ ਦਾ ਬਹੁਤ ਜ਼ਿਆਦਾ ਬਿਜ਼ਨਸ ਹੈ ਬਹੁਤ ਵੱਡੇ ਵੱਡੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ ਜੋ ਕਿ ਪਿਛਲੇ ਦਸ ਤੋਂ ਪੰਦਰਾਂ ਸਾਲਾਂ ਤੋਂ ਹੀ ਬਣੀਆ ਹਨ ਇਸ ਤੋਂ ਇਲਾਵਾ ਇੱਥੇ ਕੋਲ ਸੈਂਟਰ ਦੀ ਇੰਡਸਟਰੀ ਬਹੁਤ ਵੱਧ ਗਈ ਹੈ ਅਤੇ ਪੂਰੇ ਪੰਜਾਬ ਭਰ ਤੋਂ ਮੁੰਡੇ ਕੁੜੀਆਂ ਇੱਥੇ ਜੋਬ ਕਰਨ ਵਾਸਤੇ ਆਉਂਦੇ ਹਨ ਅਤੇ ਹੋਰ ਅੱਜ ਕੱਲ੍ਹ ਦੀ ਬੇਰੁਜ਼ਗਾਰੀ ਵਿੱਚ ਕੋਈ ਹੋਰ ਵਧੀਆ ਕੋਈ ਨੌਕਰੀ ਨਾ ਹੋਣ ਕਰਕੇ ਲੋਕ ਕਾਲ ਸੈਂਟਰ ਨੂੰ ਹੀ ਪ੍ਰੈਫਰੈਂਸ ਦੇਣ ਲੱਗ ਗਏ ਹਨ ਅਤੇ ਅਗਰ ਹੋਰ ਕਾਰੋਬਾਰ ਦੇਖਿਆ ਜਾਵੇ ਤਾਂ ਲੋਹੇ ਦੀ ਜਿਹੜੀ ਕੁਰਸੀਆਂ ਬਣਦੀਆਂ ਹਨ ਉਹਦਾ ਕਾਫ਼ੀ ਇੱਥੇ ਕਾਰੋਬਾਰ ਹੈ ਅਤੇ ਹੋਰ ਫਰਨੀਚਰ ਨਾਲ਼ ਸੰਬੰਧਿਤ ਜਿਹੜੀ ਵੀ ਕੋਈ ਐਟਮ ਬਣਦੀ ਹੈ ਉਹ ਮੋਹਾਲੀ ਜ਼ਿਲ੍ਹੇ ਵਿੱਚ ਜਾਂ ਨਾਲ਼ ਲੱਗਦੇ ਪਿੰਡਾਂ 'ਚ ਸਪਲਾਈ ਹੁੰਦੀ ਹੈ ਤੇ ਅਤੇ ਹੋਰ ਦੇਖਿਆ ਜਾਵੇ ਤਾਂ ਫੂਡ ਦੀ ਮਾਰਕਿਟ ਬਹੁਤ ਵੱਧ ਗਈ ਹੈ ਜੋ ਕਿ ਪਿਛਲੇ ਦਸ ਤੋਂ ਪੰਦਰਾਂ ਸਾਲਾਂ ਬਾਅਦ ਤੱਕ ਇੱਥੇ ਕੋਈ ਖ਼ਾਸ ਦੁਕਾਨਾਂ ਨਹੀਂ ਹੁੰਦੀਆਂ ਸਨ ਪਰ ਅੱਜ ਦੇਖਿਆ ਜਾਵੇ ਤੁਹਾਨੂੰ ਹਰ ਗਲੀ ਨੁਕੜ ਦੇ ਕੋਈ ਨਾ ਕੋਈ ਸਟੀਟ ਮਾਰਕੀਟ ਬਣ ਜਾਂਦੀ ਹੈ ਜਾਂ ਕੋਈ ਗੁਜਰਾਤ ਦਾ ਖਾਣਾ ਸਿੱਕਮ ਦਾ ਖਾਣਾ ਜਾਂ ਕੋਈ ਦੱਖਣ ਦਾ ਖਾਣਾ ਉਸ ਲੋਕ ਬੁਲਾਉਂਦੇ ਹਨ ਤਾਂ ਉਹ ਬੜੇ ਚਾਵਾਂ ਨਾਲ਼ ਖਾਂਦੇ ਹਨ ਅਤੇ ਉਹ ਇਸ ਤੋਂ ਇਸ ਤੋਂ ਇਲਾਵਾ ਜਿਹੜੇ ਇੱਥੋਂ ਦੇ ਲੋਕਲ ਬਿਜਨਸਮੈਨ ਹੈ ਬਿਜਨਸਮੈਨ ਹਨ ਉਹਨਾਂ ਨੂੰ ਚੁਣੌਤੀਆਂ ਹੋਰ ਵੱਧ ਗਈਆਂ ਹਨ ਉਹਨਾਂ ਨੂੰ ਬਿਜ਼ਨਸ ਨੂੰ ਜਾਂ ਤਾਂ ਬਦਲਣਾ ਪੈ ਰਿਹਾ ਜਾਂ ਹੋਰ ਐਕਸਪੈਂਡ ਕਰਨਾ ਪੈ ਰਿਹਾ ਅਤੇ ਇਸ ਚੁਣੌਤੀਆਂ ਭਰੇ ਬਿਜ਼ਨਸ ਵਿੱਚ ਸਭ ਨੂੰ ਬਸ ਬੀ ਆਪਣਾ ਕਾਰੋਬਾਰ ਚਲਾਉਣਾ ਪੈ ਰਿਹਾ